ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕਾਂ ਨੂੰ ਕਈ ਕਾਨੂੰਨੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸਕਰ ਪਿੰਡਾਂ ਵਿੱਚ ਪੇਂਡੂ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਵਿੱਚ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਜਿਵੇਂ ਕਿ ਪਿੰਡ ਵਿੱਚ ਪੁਲਿਸ ਸਟੇਸ਼ਨਜ਼ ਹੀ ਨਹੀਂ ਹੁੰਦੇ ਕਈ ਵਾਰ ਤਾਂ ਜੇ ਉਹਨਾਂ ਨੂੰ ਕੋਈ ਪੁਲਿਸ ਸਟੇਸ਼ਨ ਮਿਲ ਵੀ ਜਾਂਦਾ ਹੈ ਤਾਂ ਉੱਥੋਂ ਦੇ ਪੁਲਿਸ ਇੰਸਪੈਕਟਰ ਇੰਨੇ ਕਰਪਟਡ ਹੁੰਦੇ ਹਨ ਕਿ ਉਹਨਾਂ ਦਾ ਸਾਥ ਹੀ ਨਹੀਂ ਦਿੰਦੇ ਜੇਕਰ ਉਹ ਉਹਨਾਂ ਦਾ ਸਾਥ ਵੀ ਦੇ ਦੇਣ ਤਾਂ ਉਹਨਾਂ ਨੂੰ ਕੋਈ ਵਧੀਆ ਅਕ ਵਕੀਲ ਹੀ ਨਹੀਂ ਮਿਲਦਾ ਜੋ ਉਹਨਾਂ ਦੀ ਗੱਲ ਨੂੰ ਸਮਝੇ ਅਤੇ ਸੁਣੇ ਇਸ ਪ੍ਰਕਾਰ ਪਿੰਡ ਵਿੱਚ ਲੋਕਾਂ ਨੂੰ ਕਈ ਕਾਨੂੰਨੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਮੈਂ ਇਹ ਚਾਹੂੰਗੀ ਕਿ ਪਿੰਡ ਵਿੱਚ ਪੁਲਿਸ ਸਟੇਸ਼ਨਸ ਵੀ ਹੋਣ ਅਤੇ ਕਰਪਸ਼ਨ ਘੱਟ ਜਾਵੇ ਜਿਹਦੇ ਕਰਕੇ ਲੋਕ ਆਪਣੀ ਸੁਣਵਾਈ ਪੇਸ਼ ਕਰ ਸਕਣ ਅਤੇ ਵਧੀਆ ਤੋਂ ਵਧੀਆ ਵਕੀਲ ਉਹਨਾਂ ਨੂੰ ਘੱਟ ਤੋਂ ਘੱਟ ਪੈਸੇ ਵਿੱਚ ਮਿਲ ਜਾਣ